ਹੈਲੋ ਹਾਂਜੀ ਹਾਂਜੀ

ਅੱਛਾ ਅੱਛਾ ਅੱਛਾ ਕਿੰਨੇ ਦਿਨਾਂ ਵਾਸਤੇ ਚਾਹੀਦੀ ਲੀਵ ਥ੍ਰੀ ਡੇਜ਼ ਵਾਸਤੇ ਵਿੱਚ ਪੇਪਰ ਵਗੈਰਾ ਵੀ ਹੋਣੇ ਹੈ ਅਤੇ ਅਗਰ ਲੀਵ ਚਾਹੀਦੀ ਆ ਤਾਂ ਤੁਸੀਂ ਰਿਟਨ 'ਚ ਇਕ ਐਪਲੀਕੇਸ਼ਨ ਘਿਲਾ ਦੇਣਾ ਸਕੂਲ ਮਨਵੀਰ ਦੇ ਹੱਥ 'ਚ ਅਤੇ ਫਿਰ ਉਹ ਐਪਲੀਕੇਸ਼ਨ ਦੇ ਅਕੋਰਡਿੰਗ ਹਾਂਜੀ ਹਾਂਜੀ ਜੇ ਹਾਂਜੀ ਹਾਂ ਬਸ ਦੋਨੋਂ ਪੇਰੈਂਟਸ ਦੇ ਸਾਈਨ ਹੋਣੇ ਚਾਹੀਦੇ ਹੈ ਫਿਰ ਉਸ ਲੀਵ 'ਚ ਅਤੇ ਫਿਰ ਉਹ ਪ੍ਰਿੰਸਪਲ ਮੈਮ ਨਾਲ ਮੈਂ ਗੱਲ ਕਰ ਲਾਂਗੀ ਅਤੇ ਉਹਦੇ ਅਕੋਰਡਿੰਗ ਅਗਰ ਉਹ ਕਹਿਣਗੇ ਕਿ ਮਿਲ ਜਾਏਗੀ ਲੀਵ ਤਾਂ ਮੈਂ ਤੁਹਾਨੂੰ ਇਨਫੋਰਮ ਕਰ ਦਾਂਗੀ ਅਤੇ ਇੱਦਾਂ ਹੀ ਹੋ ਸਕਦਾ ਹਾਂ ਹਾਂਜੀ ਹਾਂਜੀ ਜੇ ਤੁਹਾਨੂੰ ਇੱਦਾਂ 'ਚ ਤੁਸੀਂ ਟੈਸਟ ਦਿਵਾਉਣਾ ਇਹਦਾ ਤਾਂ ਤੁਸੀਂ ਐਪਲੀਕੇਸ਼ਨ 'ਚ ਲਿਖ ਦੇਣਾ ਕਿ ਉਹ ਤਿੰਨ ਦਿਨ ਬਾਅਦ ਜਦੋਂ ਆਏਗਾ ਤਾਂ ਉਹ ਟੈਸਟ ਜ਼ਰੂਰ ਦਏਗਾ ਠੀਕ ਹੈ ਤਾਂ ਫਿਰ ਉਹ ਤੁਹਾਡੀ ਹਾਂ ਫਿਰ ਟੈਸਟ ਦਿੱਤਾ ਜਾਏਗਾ ਅਤੇ ਫਿਰ ਇਹਦੀ ਉੱਥੇ ਐ ਐਬਸੈਂਟ ਨਹੀਂ ਲੱਗੇਗੀ ਅਦਰਵਾਈਜ਼ ਉਹਦੇ ਵਿੱਚ ਐਬਸੈਂਟ ਲੱਗ ਗਈ ਤਾਂ ਫਿਰ ਇਹਦੇ ਅਸੈਸਮੈਂਟ ਘੱਟ ਹੋ ਜਾਏਗੀ ਤਾਂ ਤੁਸੀਂ

ਹਾਂਜੀ ਕੋਸ਼ਿਸ਼ ਪੂਰੀ ਕਰਨਗੇ ਬਾਕੀ ਦੇਖੋ ਅੱਗੇ ਮੈਮ ਕੀ ਕਹਿੰਦੇ ਆ ਫਿਰ ਉਹਦੇ ਤੁਹਾਨੂੰ ਤੁਹਾਨੂੰ ਮੈਂ ਦੱਸਾਂਗੀ ਕਿੱਦਾਂ ਹੋਏਗਾ ਠੀਕ ਹੈ ਅੱਛਾ ਹਾਂ ਨਹੀਂ ਉਹ ਤੋ ਗੱਲ ਹੈਗੀ ਆ ਪਰ ਅਹ ਇ ਇਗਜ਼ਾਮਸ ਵੀ ਜਦੋਂ ਵਿੱਚ ਆ ਜਾਣ ਤਾਂ ਉਹ ਵੀ ਜ਼ਰੂਰੀ ਹੈ ਨਹੀਂ ਤਾਂ ਫਿਰ ਉਹ ਬੱਚੇ ਦਾ ਲੋਸ ਹੁੰਦਾ ਹਾਂ ਉਹ ਫਿਰ ਮੈਮ ਨਾ ਹੁਣ ਗੱਲ ਕਰਕੇ ਬਣੇਗਾ ਅਗਰ ਉਹ ਕਹਿਣਗੇ ਕਿ ਇੱਦਾਂ ਐਜਸਟ ਹੋ ਜਾਂਦਾ ਤਾਂ ਫਿਰ ਕਰਦੇ ਨੇ ਫਿਰ ਤੁਸੀਂ ਇਹ ਨਾ ਲਿਖਣਾ ਕਿ ਉਹ ਟੈਸਟ ਬ ਆ ਕੇ ਦੇ ਦੇਗਾ ਫਿਰ ਉਹ ਬਾਅਦ 'ਚ ਇਹ ਦੇਖ ਲਾਂਗੇ ਕਿ ਕਿੱਦਾਂ ਇਹਨੂੰ ਕਰ ਦੇਣਾ ਐਜਸਟ ਠੀਕ ਹੈ ਹਾਂਜੀ ਹਾਂਜੀ ਹਾਂ ਕੋਈ ਗੱਲ ਨਹੀਂ ਮੈਂ ਤੁਸੀਂ ਬਸ ਇੱਕ ਐਪਲੀਕੇਸ਼ਨ ਘਲਾਓ ਅਤੇ ਮੈਂ ਉਹ ਸਾਈਨ ਕਰਵਾ ਕੇ ਫਿਰ ਤੁਹਾਨੂੰ ਇਨਫੋਰਮ ਕਰ ਦਾਂਗੀ ਕੋਈ ਗੱਲ ਨਹੀਂ ਦੇਖ ਲਾਂਗੇ ਅਸੀਂ ਹੋਏਗਾ ਕਿ ਮੈਂ ਕਰਾ ਦਾਂਗੀ ਠੀਕ ਹੈ ਜੀ ਓਕੇ ਜੀ ਓਕੇ ਸਤਿ ਸ਼੍ਰੀ ਅਕਾਲ